ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ ਠੀਕ ਹੈ ਸਾਰੇ ਘਰ ਹੋਰ ਕੀ ਹਾਲ ਚਾਲ ਹੈ ਉਹ ਬੱਚਿਆਂ ਨੂੰ ਛੁੱਟੀਆਂ ਹੋਈਆਂ ਪਈਆਂ ਸੀ ਅਤੇ ਅਸੀਂ ਘੁੰਮਣ ਆਉਣਾ ਸੀ ਹਾਂ ਅਤੇ ਤੁਹਾਡੇ ਉੱਥੇ ਫਿਰ ਮਾਨਸਾ ਘੁੰਮਣ ਆਉਣਾ ਸੀ ਅਸੀਂ ਅਤੇ ਉੱਥੇ ਕਿਹੜੀਆਂ ਕਿਹੜੀਆਂ ਜਗ੍ਹਾ ਹੈਗੀਆਂ ਘੁੰਮਣ ਵਾਲੀਆਂ ਹਾਂਜੀ ਹੋਰ ਕੀ ਹੈਗਾ ਅੱਛਾ ਪਾਰਕ ਹੈਗੇ ਹੈ ਅੱਛਾ ਸਿੱਧੂ ਮੂਸੇਵਾਲੇ ਦੀ ਅੱਛਾ ਅੱਛਾ ਉੱਥੇ ਫਿਰ ਜਿਵੇਂ ਸਿੱਧੂ ਮੂਸੇਵਾਲੇ ਦੀ ਕੋਠੀ 'ਚ ਕੋਈ ਐਂਟਰੀ ਟਿਕਟ ਹੈਗੀ ਆ ਵੀ ਉੱਥੇ ਜਾਣ ਦਿੰਦੇ ਅੰਦਰ ਕੋਈ ਜਾਣ ਦੀ ਮਨਾ ਹੈ ਅੱਛਾ ਅੱਛਾ ਚਲੋ ਉਹ ਤਾਂ ਵੀ ਬਹੁਤ ਵਧੀਆ ਸਿੰਗਰ ਹੈਗਾ ਸੀ ਜਿਵੇਂ ਹੈ ਨਾ ਬੱਚਿਆਂ ਨੂੰ ਵੀ ਬੜਾ ਪਸੰਦ ਹੈ ਜਿਵੇਂ ਬਾਹਰ ਗਿਆ ਹੋਇਆ ਸੀ ਤਾਂ ਵੀ ਅਗਲਾ ਬਾਹਰ ਨਹੀਂ ਰਿਹਾ ਆਪਦੇ ਦੇਸ਼ ਨੂੰ ਉਹਨੇ ਉਹ ਦਿੱਤਾ ਹੈਗਾ ਹਾਂਜੀ

ਹੋਰ ਚਲੋ ਦੇਖਦੇ ਹਾਂ ਅਸੀਂ ਫਿਰ ਪ੍ਰੋਗਰਾਮ ਬਣਾਵਾਂਗੇ ਪ੍ਰੋਗਰਾਮ ਬਣਾਵਾਂਗੇ ਬੱਚਿਆਂ ਨੂੰ ਲੈ ਕੇ ਆਵਾਂਗੇ ਕੋਈ ਬੱਚਿਆਂ ਲਈ ਹੋਰ ਨੌਲੇਜ ਵਧੇਗੀ ਕੋਈ ਉੱਥੇ ਦੀਆਂ ਹੋਰ ਵੀ ਚੀਜ਼ਾਂ ਦਿਖਾਵਾਂਗੇ ਜਦੋਂ ਉੱਥੇ ਵੀ ਦੇਖਾਂਗੇ ਫਿਰ ਅਸੀਂ ਵੀ ਹੋਰ ਪਾਰਕ ਵੀ ਦੇਖ ਘੁੰਮਾ ਲਵਾਂਗੇ ਚੱਲ ਪਾਰਕ 'ਚ ਵੀ ਘੁੰਮ ਆਉਣਗੇ ਪਹਿਲਾਂ ਸਿੱਧੂ ਮੂਸੇਆਲੇ ਦੀ ਕੋਠੀ ਵੇਖਣ ਚਲੇ ਜਾਂਗੇ

ਚਲੋ ਠੀਕ ਹੈ ਧੰਨਵਾਦ